ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਨਾ ਸਰ ਤੁਹਾਡੇ ਨਾਲ ਇਕ ਸਲਾਹ ਕਰਨੀ ਚਾਹੁੰਦੀ ਸੀ ਵੀ ਆਪਾਂ ਆਪਣੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜੇ ਬੱਚੇ ਦੀ ਐਡਮਿਸ਼ਨ ਕਰਾਉਣੀ ਹੋਵੇ ਤਾਂ ਸਭ ਤੋਂ ਵਧੀਆ ਸਕੂਲ ਤੁਹਾਡੇ ਮੁਤਾਬਿਕ ਕਿਹੜਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਠੀਕ ਹ ਹਾਂਜੀ ਹਾਂਜੀ ਠੀਕ ਐ ਜੀ ਹਾਂਜੀ ਠੀਕ ਐ ਜੀ ਅੱਛਾ ਜੀ ਠੀਕ ਹ ਜੀ ਹਾਂ ਹਾਂ ਹਾਂ ਨੀ ਸਰ ਪਤਾ ਕੀ ਜੀ ਜਿਹੜੀ ਸਰਕਾਰੀ ਸਕੂਲ ਨੇ ਹਨਾ ਉਹ ਤਾਂ ਆਪਣੇ ਜਿਹੜਾ ਸਟੇਟ ਬੋਰਡ ਦੇ ਨਾਲ ਸੰਬੰਧਿਤ ਰੱਖਦੇ ਨੇ ਹਨਾ ਤੇ ਜਿਵੇਂ ਆਪਾਂ ਸੈਂਟਰ ਦੇ ਨਾਲ ਜੇ ਆਪਾਂ ਕੰਸਰਨ ਕਰਨੀ ਜਿਵੇਂ ਸੀਬੀਐਸਈ ਦੇ ਸਕੂਲ ਨੇ ਹਨਾ ਉਹਦੇ ਵਿੱਚ ਮੇਰੇ ਹਿਸਾਬ ਨਾਲ ਤੁਹਾਡੀ ਗੱਲ ਬਿਲਕੁਲ ਸਹੀ ਕਿ ਸਰਵਿਤਕਾਰੀ ਸਕੂਲ ਜਿਆਦਾ ਵਧੀਆ ਮੈਨੂੰ ਉਥੋਂ ਦੇ ਪ੍ਰਿੰਸੀਪਲ ਉਥੋਂ ਦਾ ਜਿਹੜਾ ਸਟਾਫ ਹੈ ਤੇ ਉਹ ਜਿਆਦਾ ਕੇਅਰਿੰਗ ਹੈ ਬੱਚਿਆਂ ਦੇ ਲਈ ਔਰ ਬੱਚੇ ਵੀ ਬੜੇ ਸ਼ਾਂਤਮਈ ਮਾਹੌਲ ਵਿੱਚ ਉੱਥੇ ਪੜ੍ਹਦੇ ਨੇ ਵੀ ਉਥੇ ਮੈਂ ਕੋਈ ਜਿਆਦਾ ਇਧਰ ਦੀਆਂ ਗੱਲਾਂ ਨਹੀਂ ਸੁਣੀਆਂ ਬੱਚਿਆਂ ਬਾਰੇ ਬੱਚੇ ਜਿਆਦਾ ਸ਼ਰਾਰਤੀ ਨੇ ਹਾਂਜੀ ਹਾਂਜੀ ਹਾਂ ਚਲੋ ਠੀਕ ਹ ਜੀ ਮੈਂ ਮਤਲਬ ਕਿ ਮੈਂ ਤਾਂ ਸਿਰਫ ਤੁਹਾਡੇ ਤੋਂ ਇਹੀ ਸਲਾਹ ਲੈਣੀ ਸੀ ਵੀ ਜੋ ਮੈਂ ਸੋਚ ਰਹੀ ਆ ਉਹ ਸਹੀ ਸੋਚ ਰਹੀ ਆ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ